ਜੀ ਹਾਂ ਸਾਡੇ ਖੇਤਰ ਵਿੱਚ ਸਮੇਂ ਦੇ ਨਾਲ ਔਰਤਾਂ ਦੀ ਭੂਮਿਕਾ ਬਦਲੀ ਹੈ ਕੀ ਜੀ ਜਿਵੇਂ ਤੁਸੀਂ ਜਾਣਦੇ ਹੀ ਹੋ ਹੁਣ ਪੰਜਾਬ ਸਰਕਾਰ ਨੇ ਨੌਕਰੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਇਸ ਨਾਲ ਕੀ ਹੋਇਆ ਹੈ ਕੀ ਹੁਣ ਜੋ ਪਿੰਡੋ ਔਰਤਾਂ ਸੀ ਜੋ ਪੜ੍ਹ ਲਿਖ ਕੇ ਸਿਰਫ ਘਰ ਦਾ ਹੀ ਕੰਮ ਕਰਨ ਜਾਣ ਦੀਆਂ ਸਨ ਹੁਣ ਉਹ ਆਪਣੇ ਪੇਪਰ ਕਲੀਅਰ ਕਰਕੇ ਪਟਵਾਰੀ ਪੁਲਿਸ ਅਤੇ ਹੋਰ ਮਹਿਕਮਾ ਨੂੰ ਵੀ ਹੁਣ ਜੁਆਇਨ ਕਰ ਰਹੀਆਂ ਹਨ ਤੇ ਹਾਂ ਅਜੋਕੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਕੀ ਸਾਡੇ ਇਲਾਕੇ ਵਿੱਚ ਔਰਤਾਂ ਦੀ ਭੂਮਿਕਾ ਬਦਲੀ ਹੈ ਪਰ ਹਜੇ ਵੀ ਕਿਤੇ ਕਿਤੇ ਥੋੜੀਆਂ ਜਿਹੀਆਂ ਰੁਕਾਵਟਾਂ ਪੇਸ਼ ਆਉਂਦੀਆਂ ਹਨ ਜਿਵੇਂ ਕੀ ਰਾਤ ਨੂੰ ਔਰਤ ਦਾ ਇਕੱਲੇ ਨਿਕਲਨਾ ਬਾਹਰ ਬਹੁਤ ਜਿਆਦਾ ਮੁਸ਼ਕਿਲ ਐ ਕਿਉਂਕੀ ਇਹ ਅਸੀਂ ਦੇਖ ਸਕਦੇ ਹਾਂ ਜਿਵੇਂ ਬੈਸਟ ਬੰਗਾਲ ਵਿੱਚ ਹੁਣੇ ਹੁਣੇ ਹੀ ਰਾਤ ਨੂੰ ਰੇਪ ਵੀ ਹੋਇਆ ਔਰਤਾਂ ਦਾ ਤੇ ਉਹਨਾਂ ਦੀ ਸੁਰੱਖਿਆ ਲਈ ਥੋੜਾ ਜਿਹਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਤੇ ਇਸ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹੈ